ਬਾਈਕਿੰਗ ਦੇ ਸ਼ੌਂਕ ਪੂਜਣੇ ਸੌਖੇ ਨਹੀਂ ਹਨ ਬਾਈਕਿੰਗ ਚਲਾਅ ਬਾਈਕ ਕਰਦੇ ਹੋਏ ਬਹੁਤ ਜ਼ਿਆਦਾ ਦਿੱਕਤਾਂ ਵੀ ਸਾਹਮਣੇ ਆਉਂਦੀਆਂ ਹਨ ਮੋਟਰਸਾਈਕਲ ਚਲਾਉਂਦੇ ਹੋਏ ਭਾਰਤੀ ਸੜਕਾਂ ਅਤੇ ਵਿਦੇਸ਼ੀ ਸੜਕਾਂ ਵਿੱਚ ਵੀ ਕਾਫੀ ਫ਼ਰਕ ਹੈ ਭਾਰਤੀ ਸੜਕ ਵਿੱਚ ਕਾ ਕਈ ਤਾਂ ਕਾਫੀ ਜ਼ਿਆਦਾ ਵਧੀਆ ਬਣੀਆਂ ਹੋਈਆਂ ਹਨ ਜਿੱਦਾਂ ਕਿ ਨੈਸ਼ਨਲ ਹਾਈਵੇ ਪਰ ਵਿੱਚੋਂ ਭਾਰਤ ਦੇ ਅੰਦਰੀ ਇਲਾਕੇ ਰੂੜੀ ਇਲਾਕਿਆਂ ਵਿੱਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਕਈ ਵਾਰ ਅੰਦਰੂਨੀ ਇਲਾਕਿਆਂ ਦੇ ਵਿੱਚੋਂ ਲੰਘਦੇ ਲੰਘਦੇ ਮੋਟਰਸਾਈਕਲ ਨੂੰ ਬਹੁਤ ਧਿਆਨ ਨਾਲ ਅਤੇ ਬਹੁਤ ਧਿਆਨ ਦੇਖ ਕੇ ਚਲਾਉਣਾ ਪੈਂਦਾ ਹੈ ਤਾਂ ਕਿ ਕੋਈ ਮੋਟਰਸਾਈਕਲ ਨੂੰ ਕੋਈ ਨੁਕਸਾਨ ਨਾ ਆ ਜਾਵੇ ਉਦੋਂ ਉਸ ਤੋਂ ਬਾਅਦ ਮੋਟਰਸਾਈਕਲ ਨੂੰ ਉਸ ਦੀ ਮੈਨਟੇਨੈਂਸ ਕਰਵਾਉਣੀ ਮੌਕੇ ਮੌਕੇ 'ਤੇ ਪੂਰੇ ਟਾਈਮ 'ਤੇ ਰੱਖਣੀ ਜ਼ਰੂਰੀ ਹੈ ਇਸ ਦੀ ਸਰਵਿਸ ਕਰਵਾ ਕੇ ਰੱਖਣੀ ਜ਼ਰੂਰੀ ਹੈ ਮੋਟਰਸਾਈਕਲ ਦੀ ਸਰਵਿਸ ਲਗਾਤਾਰ ਪੂਰੇ ਟਾਈਮ 'ਤੇ ਪੂਰੀ ਰੱਖਣ ਨਾਲ ਹੀ ਮੋਟਰਸਾਈਕਲ ਸਹੀ ਚਲਦਾ ਹੈ ਵਰਨਾ ਉਸ ਨੂੰ ਕਾਫੀ ਦਿੱਕਤ ਆ ਜਾਂਦੀ ਹੈ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਤੋਂ ਬਾਅਦ ਉਸ ਨੂੰ ਚਲਾਉਣ ਵਾਲੇ ਇਲਾਕੇ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਕਿਹੜੇ ਇਲਾਕਿਆਂ ਵਿੱਚ ਚੱਲ ਰਿਹਾ ਹੈ ਮੋਟਰਸਾਈਕਲ ਚੱ ਚੱਲੇ ਜ਼ਿਆਦਾ ਖ ਖਸਤਾ ਹਾਲਤ ਸੜਕਾਂ ਉੱਤੇ ਚੱਲੇ ਤਾਂ ਵੀ ਦਿੱਕਤ ਹੈ ਕਿਉਂਕਿ ਮੋਟਰਸਾਈਕਲ ਦੇ ਸ਼ੌਕਰਾਂ ਅਤੇ ਹੋਰਨਾਂ ਪਾਰਟਸ ਨੂੰ ਵੀ ਦਿੱਕਤ ਆਉਂਦੀ ਹੈ ਕਈ ਵਾਰ ਸੜਕ ਦੇ ਉੱਤੇ ਵਿਜੀ ਸੜਕ ਦੇ ਉੱਤੇ ਮੋਟਰਸਾਈਕਲ ਚਲਾਉਣਾ ਵੀ ਹਾਨੀਕਾਰਕ ਅਤੇ ਦੁ ਦੁਵਿਧਾ ਪੂਰਵਕ ਹੋ ਜਾਂਦਾ ਹੈ ਚਲਦੀ ਸੜਕ ਉਤੇ ਬਰੇਕਾਂ ਜ਼ਿਆਦਾ ਲੱਗਦੀਆਂ ਹਨ ਜਿਸ ਕਾਰਨ ਮੋਟਰਸਾਈਕਲ ਦੇ ਬਰੇਕ ਪੈਡਕ ਦੇ ਘਸਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਹਨ ਬਰੇਕ ਪੈਡ ਜ਼ਿਆਦਾ ਘਸਣ ਕਾਰਨ ਮੋਟਰਸਾਈਕਲ ਨੂੰ ਕਾਫੀ ਦਿੱਕਤ ਆ ਜਾਂਦੀ ਹੈ ਅਤੇ ਬਰੇਕਾਂ ਸਮੇਂ ਸਿਰ ਨਹੀਂ ਲੱਗ ਪਾਉਂਦੀਆਂ ਇਸ ਤੋਂ ਇਲਾਵਾ ਜਦੋਂ ਮੋਟਰਸਾਈਕਲ ਨੂੰ ਪਹਾੜਾਂ ਉਤੇ ਲੈ ਕੇ ਜਾਣਾ ਹੁੰਦਾ ਹੈ ਤਾਂ ਉਹਦੀ ਸਰਵਿਸ ਤਾਂ ਪਹਿਲਾਂ ਹੀ ਕਰਵਾਉਣੀ ਪੈਂਦੀ ਹੈ ਸਾਰੇ ਤਾ ਸਾਰਾ ਕੁਝ ਚੈੱਕ ਕਰਵਾਉਣਾ ਪੈਂਦਾ ਹੈ ਉਸ ਤੋਂ ਬਾਅਦ ਮੋਟਰਸਾਈਕਲ ਨੂੰ ਉਸ ਪਹਾੜੀ ਇਲਾਕਿਆਂ ਵਿੱਚ ਧਿਆਨ ਨਾਲ ਚਲਾਉਣਾ ਪੈਂਦਾ ਹੈ ਕਿਉਂਕਿ ਪਹਾੜੀ ਇਲਾਕਿਆ ਵਿੱਚ ਮੌਸਮ ਜ਼ਿਆਦਾਤਰ ਖ਼ਰਾਬ ਹੀ ਰਹਿੰਦਾ ਹੈ ਅਤੇ ਉੱਥੇ ਦੀਆਂ ਸੜਕਾਂ ਵੀ ਮੇਨ ਮੇਨ ਸੜਕਾਂ ਨੈਸ਼ਨਲ ਹਾਈਵੇ ਤਾਂ ਪਹਾੜਾਂ ਵਿੱਚ ਕਾਫੀ ਸੋਹਣੇ ਬਣੇ ਹੋਏ ਹਨ ਪਰ ਜਿਹੜੇ ਸੜਕ ਜਿਹੜਿਆਂ ਸੜਕਾਂ ਅੰਦਰਲੇ ਪਾਸੇ ਸ਼ਹਿਰਾਂ ਨੂੰ ਕੋਨੈਕਟ ਕਰਦੀਆਂ ਹਨ ਉਹਨਾਂ ਸੜਕਾਂ ਵਿੱਚ ਕਾਫੀ ਦਿੱਕਤ ਹੈ ਜਮੀਨ ਵੀ ਪਹਾੜਾਂ ਵਿੱਚ ਹੋਰ ਵੀ ਬਹੁਤ ਕੁਛ ਹੁੰਦਾ ਰਹਿੰਦਾ ਹੈ ਜਿਵੇਂ ਜਮੀਨ ਖਿਸਕ ਜਾਂਦੀ ਹੈ ਅਤੇ ਜੰਗਲੀ ਜਾਨਵਰ ਵੀ ਸੜਕਾਂ ਦੇ ਸਾਹਮਣੇ ਆ ਜਾਂਦੇ ਹਨ ਜਿਸ ਕਾਰਨ ਦਿੱਕਤ ਹੋਰ ਵੱਧ ਜਾਂਦੀ ਹੈ ਜੰਗਲੀ ਜਾਨਵਰਾਂ ਦੇ ਮੁਹਰੇ ਆਉਣ ਕਰਨ ਅਚਾਨਕ ਬਰੇਕ ਲਾਉਣੀ ਪੈ ਜਾਂਦੀ ਹੈ ਅਤੇ ਅਚਾਨਕ ਬਰੇਕ ਲੱਗਣ ਕਾਰਨ ਮੋਟਰਸਾਈਕਲ ਕਈ ਵਾਰ ਨਹੀਂ ਰੁਕਦਾ ਹੈ ਅਤੇ ਉਹ ਦੁਰਘਟਨਾ ਦੁਰਘਟਨਾ ਦਾ ਕਾਰਨ ਬਣਦਾ ਹੈ ਖ਼ਰਾਬ ਮੌਸਮ ਖ਼ਰਾਬ ਟਰੈਫਿਕ ਵੀ ਕਾਫੀ ਜ਼ਿਆਦਾ ਮੋਟਰਸਾਈਕਲ ਚਲਾਉਣ ਵਿੱਚ ਦਿੱਕਤ ਦਾ ਸਾਬਤ ਕਰਦਾ ਹੈ ਮੌਸਮ ਖ਼ਰਾਬ ਹੋਣ ਕਾਰਨ ਮੋਟਰਸਾਈਕਲ ਚਲਾਉਣ ਵਿੱਚ ਹੋਰ ਦਿੱਕਤ ਆਉਂਦੀ ਹੈ ਅਤੇ ਟਰੈਫਿਕ ਜ਼ਿਆਦਾ ਹੋਣ ਕਾਰਨ ਵੀ ਮੋਟਰਸਾਈਕਲ ਦੀਆਂ ਸਮੇਂ ਸਿਰ ਬਰੇਕਾਂ ਲੱਗਦੀਆਂ ਹਨ ਅਤੇ ਮੋਟਰਸਾਈਕਲ ਐਵਰੇਜ ਨਹੀਂ ਕੱਢ ਪਾਉਂਦਾ ਐਵਰੇਜ ਕੱਢ ਪਾਉਣੀ ਵੀ ਮੋਟਰਸਾਈਕਲ ਸਿੱਧੀ ਸੜਕ ਦੇ ਉੱਤੇ ਇੱਕ ਸਪੀਡ 'ਤੇ ਚੱਲਦਾ ਹੈ ਤਾਂ ਜੋ ਤਾਂ ਜੋ ਮੋਟਰਸਾਈਕਲ ਐਵਰੇਜ ਦੇ ਪਾਉਂਦਾ ਹੈ ਪਰ ਟਰੈਫਿਕ ਜ਼ਿਆਦਾ ਹੋਣ ਕਾਰਨ ਬਿਜੀ ਇਲਾਕਿਆਂ ਵਿੱਚ ਮੋਟਰ ਸਾਈਕਲ ਚਲਾਉਣ ਨਾਲ ਮੋਟਰਸਾਈਕਲ ਦੀ ਐਵਰੇਜ ਬਿਲਕੁਲ ਖ਼ਤਮ ਹੋ ਜਾਂਦੀ ਹੈ